ਸਵੱਛ ਭਾਰਤ ਅਭਿਆਨ ਵਿੱਚ ਸਾਨੂੰ ਸਫਾਈ ਕਰਨੀ ਚਾਹੀਦੀ ਹੈ ਅਤੇ ਸਵੱਛ ਭਾਰਤ ਅਭਿਆਨ ਹੀ ਸਫਾਈ ਕਰਨ ਲਈ ਬਣਿਆ ਬਣਾਇਆ ਗਿਆ ਹੈ ਸਾਨੂੰ ਆਲੇ ਆਪਣੇ ਘਰ ਦੇ ਆਪਣੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਫਿਰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਫਿਰ ਆਪਾਂ ਨੂੰ ਗਿੱਲਾ ਕੂੜਾ ਅਲੱਗ ਸੁੱਕਾ ਕੂੜਾ ਅਲੱਗ ਤਾਂ ਕਿ ਆਪਣੇ ਕੋਈ ਵੀ ਬਿਮਾਰੀ ਨਾ ਲੱਗੇ ਕੋਈ ਬਿਮਾਰੀਆਂ ਨਾ ਫੈਲਣ ਅਤੇ ਆਪਾਂ ਨੂੰ ਅਤੇ ਆਲੇ ਦੁਆਲੇ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਜਾਨਵਰ ਜਾਂ ਮਨੁੱਖਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਸ ਲਈ ਸਾਨੂੰ ਸਫਾਈ ਰੱਖਣੀ ਚਾਹੀਦੀ ਹੈ ਅਤੇ ਹਰ ਜਗ੍ਹਾ 'ਤੇ ਆਪਣੇ ਕੱਪੜੇ ਆਪਣੇ ਪਾਣੀ ਗਿੱਲਾ ਕੋਈ ਪਾਣੀ ਬੇਫਾਲਤੂ ਪਾਣੀ ਨਹੀਂ ਖਿਲਾਰਨਾ ਚਾਹੀ ਰੱਖਣਾ ਚਾਹੀਦਾ ਕੋਈ ਸਾਫ਼ ਕੱਪੜੇ ਰੱਖਣੇ ਚਾਹੀਦੇ ਆ ਅਤੇ ਆਪਣੇ ਆਲੇ ਦੁਆਲੇ ਨੂੰ ਵੀ ਸਾਫ਼ ਰੱਖੋ ਅਤੇ ਮੈਂ ਆਪਣੇ ਕੋਲਜ ਵਿੱਚ ਸਵੱਛਤਾ ਅਭਿਆਨ ਵਿੱਚ ਜ ਵੱਧ ਚੜ੍ਹ ਕੇ ਹਿੱਸਾ ਲਿੱਤਾ ਸੀ ਅਤੇ ਇਸ ਵਿੱਚ ਮੈਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਅਤੇ ਅਸੀਂ ਆਪਣੇ ਆਲੇ ਦੁਆਲੇ ਦੇ ਕੈਲੋ ਕਲੋਨੀਆਂ ਵਿੱਚ ਸਾਫ਼ ਸਫਾਈ ਕਰਨ ਲਈ ਗਏ ਸੀਗੇ ਅਤੇ ਮੇਰਾ ਆਲਾ ਦੁਆਲਾ ਹੁਣ ਬਹੁਤ ਜ਼ਿਆਦਾ ਸਾਫ਼ ਹੈ ਸੜਕਾਂ ਵਗੈਰਾ ਬਹੁਤ ਜ਼ਿਆਦਾ ਸਾਫ਼ ਹਨ ਬਸ ਉਸ ਵਿੱਚ ਇੱਕ ਕਮੀ ਹੈ ਉਹ ਵੀ ਉੱਥੇ ਕੂੜੇਦਾਰ ਰੱਖਣ ਦੀ ਕਮੀ ਹੈ ਤਾਂ ਕਿ ਕ ਕੋਈ ਵੀ ਜ਼ਿਆਦਾ ਕੋਈ ਵੀ ਜਾਂਦਾ ਰਾਹ 'ਚ ਕਚਰਾ ਨਾ ਫੈਲੇ ਅਤੇ ਨਾ ਕੋਈ ਆਸੇ ਪਾਸੇ ਕੋਈ ਕਚਰਾ ਸੁੱਟੇ